ਮੈਂ ਫਲਿਪਕਾਰਟ ਤੋਂ ਇੱਕ ਪਾਣੀ ਦੀ ਬੋਟਲ ਖਰੀਦੀ ਸੀ ਸੈਲੋ ਕੰਪਨੀ ਦੀ ਤਾਂ ਇਹ ਬਹੁਤ ਵਧੀਆ ਨਿਕਲੀ ਇਹਦੇ 'ਚ ਜੇ ਮੈਂ ਗਰਮ ਪਾਣੀ ਪਾਵਾਂ ਚੌਵੀ ਘੰਟੇ ਤੱਕ ਗਰਮ ਰਹਿੰਦਾ ਜੇ ਠੰਡਾ ਪਾਵਾ ਤਾਂ ਚੌਵੀ ਘੰਟੇ ਲਈ ਠੰਡਾ ਰਹਿੰਦਾ ਅਤੇ ਇਹ ਇੰਸੁਲੇਟਡ ਹੈ ਅਤੇ ਬਹੁਤ ਵਧੀਆ ਨਿਕਲੀ ਇਹ